ਹੈਲੋ ਗੁੱਡ ਮੋਰਨਿੰਗ ਮੈਮ ਮੈਮ ਤੁਸੀਂ ਸ਼ਰਮਾ ਬੁੱਕ ਡਿਪੋ ਤੋਂ ਬੋਲਦੇ ਹੋ ਮੈਮ ਮੈਂ ਅਰਸ਼ਪ੍ਰੀਤ ਕੌਰ ਤੁਹਾਨੂੰ ਲਿਸਟ ਭੇਜੀ ਸੀ ਬੁੱਕਸ ਦੀ ਪੰਜਾਬੀ ਸ਼ੈਲੀ ਦੀਆਂ ਮੈਮ ਮੈਂ ਹੋਰ ਬੁੱਕਸ ਲੈਣਾ ਚਾਹੁੰਦੀ ਹਾਂ ਉਹਦੇ ਵਿੱਚ ਐਡ ਕਰਵਾਉਣਾ ਚਾਹੁੰਦੀ ਹਾਂ ਕੀ ਤੁਹਾਡੇ ਕੋਲ ਹੋਰ ਬੁੱਕਸ ਅਵੇਲੇਵਲ ਨੇ ਪੰਜਾਬੀ ਕਵ ਕਵਿਤਾ ਦੀਆਂ ਜਿਵੇਂ ਦਲੀ ਦਲੀਪ ਕੌਰ ਟਿਵਾਣਾ ਹੋ ਗਈ ਅੰਮ੍ਰਿਤਾ ਪ੍ਰੀਤਮ ਮੈਨੂੰ ਮੈਮ ਅੱਛਾ ਜੀ ਅਤੇ ਹੋਰ ਮੈਨੂੰ ਪੰਜਾਬੀ ਸਾਹਿਤ ਦੀਆਂ ਪੰਜਾਬੀ ਸ਼ੈਲੀ ਦੀਆਂ ਬੁੱਕਸ ਚਾਹੀਦੀਆਂ ਹੈ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਹੋ ਗਏ ਅਤੇ ਉਹ ਭਾਈ ਵੀਰ ਸਿੰਘ ਦੀਆਂ ਹੋ ਗਈਆਂ ਗੁਰਮੁੱਖ ਸਿੰਘ ਮੁਸਾਫ਼ਰ ਦੀਆਂ ਮਿਲ ਜਾਣਗੀਆਂ ਮੈਨੂੰ ਪੰਜਾਬੀ ਕਵਿ ਤਾ ਸ਼ੈਲੀ ਦੀਆਂ ਬੁੱਕਸ

ਹਾਂਜੀ ਅਤੇ ਮੈਨੂੰ ਹੋਰ ਵੀ ਬੁੱਕਸ ਨਾਵਲ ਵੀ ਚਾਹੀਦੇ ਨੇ ਜਿਵੇਂਂ ਅੰਮ੍ਰਿਤਾ ਪ੍ਰੀਤਮ ਦਾ ਰਸੀਦੀ ਟਿਕਟ ਹੋ ਗਿਆ ਹੋਰ ਵੀ ਉਹਨਾਂ ਦੇ ਨਾਵਲ ਨੇ ਅਤੇ ਉਹਨਾਂ ਦੀਆਂ ਕਵਿਤਾ ਸ਼ੈਲੀ ਦੀਆਂ ਬੁੱਕਸ ਅਤੇ ਹੋਰ ਮੈਨੂੰ ਵਾ ਵਾਰਿਸ ਸ਼ਾਹ ਦੀ ਬੁੱਕ ਚਾਹੀਦੀ ਹੈ ਇੱਕ ਠੀਕ ਹੈ ਜੀ ਠੀਕ ਹੈ ਜੀ ਮੈਮ ਮੈਂ ਤੁਹਾਨੂੰ ਲਿਸਟ ਬਣਾ ਕੇ ਅਲੱਗ ਅਲੱਗ ਜਿਵੇਂ ਅਲੱਗ ਅਲੱਗ ਸ਼ੈਲੀ ਦੀ ਭੇਜ ਦੇਵਾਂ ਜੀ ਕਿਵੇਂ ਮੈਨੂੰ ਨ ਨ ਜਿਵੇਂ ਮੈਨੂੰ ਨਾਵਲ ਚਾਹੀਦੇ ਨੇ ਕਿੰਨੇ ਨਾਵਲ ਚਾਹੀਦੇ ਨੇ ਕਿਹੜੇ ਕਿਹੜੇ ਕਵੀ ਦੇ ਚਾਹੀਦੇ ਨੇ ਅਤੇ ਕਿਹੜੀ ਪੰਜਾਬੀ ਸਾਹਿਤ ਦੀਆਂ ਚਾਹੀਦੀਆਂ ਨੇ ਕਵਿਤਾ ਦੀਆਂ ਉਹ ਵੀ ਭੇਜ ਦੇਵਾਂਗੀ ਅਤੇ ਬਾਕੀ ਨਾਟਕ ਵੀ ਮੈਨੂੰ ਚਾਹੀਦੇ ਨੇ ਦੋ ਚਾਰ ਉਹ ਵੀ ਮਿਲ ਜਾਣਗੇ ਨਾਟਕ ਹੋ ਗਏ ਜਿਵੇਂ ਬਲਵੰਤ ਗਾਰਗੀ ਹੋ ਗਿਆ ਹੋਰ ਬਲਵੰਤ ਗਾਰਗੀ ਦੇ ਨਾਲ ਗੁਰਮੁਖ ਸ ਸਿੰਘ ਮੁਸਾਫ਼ਰ ਹੋ ਗਿਆ ਭਾਈ ਵੀਰ ਸਿੰਘ ਦੇ ਵੀ ਨਾਟਕ ਨੇ ਨਾਨਕ ਸਿੰਘ ਦਾ ਨਾ ਫੇਮਸ ਜੋ ਫੇਮਸ ਨਾ ਨਾਵਲ ਹੈ ਉਹ ਵੀ ਮੈਨੂੰ ਚਾਹੀਦਾ ਹੈ ਹਾਂਜੀ ਹਾਂਜੀ ਇੱਕ ਇੱਕ ਬੁੱਕ ਹਾਂਜੀ ਇੱਕ ਬੁੱਕ ਹੋਰ ਮੈਨੂੰ ਚਾਹੀਦੀ ਹੈ ਨਾਵ ਸੋਰੀ ਨਾਨਕ ਸਿੰਘ ਦੀ ਨ ਜਿਹੜੀ ਇੱਕ ਮਿਆਨ ਦੋ ਤਲਵਾਰਾਂ ਕਰਤਾਰ ਸਿੰਘ ਸਰਾਭਾ ਦੀ ਜਿਸ ਸਵੈ ਜੀਵਨੀ ਲਿਖੀ ਹੋਈ ਹੈ ਉਹ ਵੀ ਜ਼ਰੂਰ ਮੰਗਵਾ ਦਿਓ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਿਲ ਜਾਣਗੀਆਂ ਕਿੰਨੇ ਟਾਈਮ ਤੱਕ ਮਿਲ ਜਾਣਗੀਆਂ ਜੀ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਸ਼ਾਮ ਤੱਕ ਲਿਸਟ ਭੇਜ ਦੇਵਾਂਗੀ ਉਹਨਾਂ ਦੀ ਓਕੇ